ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਨਸੀ ਹੈ ਮੈਂ ਹਰ ਵਾਰ ਹੀ ਤੁਹਾਡੀ ਏਜੰਸੀ ਤੋਂ ਹੀ ਕੈਬ ਬੁੱਕ ਕਰਦੀ ਹਾਂ ਮੈਂ ਇਸ ਵਾਰ ਵੀ ਮੈਂ ਤੁਹਾਡੇ ਹੀ ਏਜੰਸੀ ਤੋਂ ਇੱਕ ਕੈਬ ਬੁੱਕ ਕੀਤੀ ਸੀ ਸਤਾਰ੍ਹਾਂ ਸੈਕਟਰ ਤੋਂ ਲੈ ਕੇ ਤਰਤਾਲੀ ਸੈਕਟਰ ਤੱਕ ਦੀ ਅਤੇ ਤੁਹਾਡੇ ਇਸ ਕੈਬ ਡਰਾਈਵਰ ਦਾ ਨਾਮ ਹੈ ਪ੍ਰਵੀਨ ਸੋ ਮੈਂ ਉਹਦੀ ਇੱਕ ਘੰਟੇ ਤੋਂ ਇੱਥੇ ਵੇਟ ਕਰ ਰਹੀ ਹਾਂ ਪਰ ਉਹ ਹਾਲੇ ਤੱਕ ਨਹੀਂ ਪਹੁੰਚਿਆ ਮੈਂ ਉਸਨੂੰ ਦੋ ਤਿੰਨ ਵਾਰ ਕੋਲ ਕੀਤਾ ਹੈ ਇੱਕ ਵਾਰ ਉਸਨੇ ਕੋਲ ਚੱਕਿਆ ਅਤੇ ਕਹਿੰਦਾ ਮੈਂ ਪੰਜ ਮਿੰਟ ਵਿੱਚ ਆਇਆ ਬਟ ਉਹ ਨਹੀਂ ਆਇਆ ਦੂਜੀ ਵਾਰ ਫਿਰ ਮੈਂ ਉਸਨੂੰ ਕੋਲ ਕੀਤੀ ਤਾਂ ਉਹ ਕਹਿੰਦਾ ਕਿ ਮੈਂ ਦਸ ਮਿੰਟ 'ਚ ਆਇਆ ਤੀਜੀ ਵਾਰੀ ਮੈਂ ਉਸਨੂੰ ਫਿਰ ਕੋਲ ਕੀਤੀ ਉਹ ਉਹ ਬਟ ਉਸਨੇ ਮੇਰੇ ਨਾਲ ਚੰਗੀ ਤਰ੍ਹਾਂ ਬਿਲਕੁਲ ਵੀ ਗੱਲ ਨਹੀਂ ਕੀਤੀ ਪਰ ਮੈਂ ਤੁਹਾਡੀ ਏਜੰਸੀ ਦੇ ਤੌਰ 'ਤੇ ਮੈਂ ਉਸਦੀ ਹਾਲੇ ਤੱਕ ਇੱਥੇ ਇੱਕ ਘੰਟੇ ਤੋਂ ਵੇਟ ਕਰ ਰਹੀ ਹਾਂ ਮੈਂ ਆਪਣੇ ਕੰਮ ਤੋਂ ਬਹੁਤ ਜ਼ਿਆਦਾ ਲੇਟ ਹੋ ਰਹੀ ਹਾਂ ਉਹ ਹਾਲੇ ਤੱਕ ਨਹੀਂ ਆਇਆ ਮੈਂ ਤੁਹਾਡੀ ਇੱਕ ਇਸ ਏਜੰਸੀ ਦੀ ਇਦ ਇਸ ਏਜੰਸੀ ਕਰਕੇ ਹੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਇਹ ਜਿਹੇ ਕੈਬ ਡਰਾਈਵਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਉ ਅਤੇ ਉਹਨਾਂ ਨੂੰ ਹਟਾਓ ਇਸ ਕੰਮ ਤੋਂ ਕਿਉਂਕਿ ਸਾਡੇ ਵਰਗੇ ਬਹੁਤ ਸਾਰੇ ਲੋਕ ਹਨ ਜੋ ਕੰਮਾਂ ਤੋਂ ਲੇਟ ਹੋ ਜਾਂਦੇ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਡੀ ਉਹ ਕੈਬ ਬੁੱਕ ਕਰਦੇ ਹਨ ਸੋ ਪਲੀਜ਼ ਇਹੋ ਜਿਹੇ ਸੋ ਪਲੀਜ ਇਹੋ ਜਿਹੇ ਕੈਬ ਡਰਾਈਵਰਾਂ ਨੂੰ ਇਹ ਜ ਕੰਮ ਉੱਤੇ ਨਾ ਰੱਖੋ